ਜ਼ਰੂਰੀ ਨਹੀਂ ਹੈ ਕਿ ਸਾਰੇ ਬੱਚੇ ਸਕੂਲੀ ਪੜ੍ਹਾਈ ਤੋਂ ਬਾਅਦ ਆਪਣਾ ਵਿਦਿਆਰਥੀ ਉੱਚ ਸਿੱਖਿਆ ਹੀ ਪ੍ਰਾਪਤ ਕਰਦੇ ਆ ਜਾਂ ਫਿਰ ਕੱਲਾ ਇੱ ਕਾਰੋਬਾਰ ਵਿੱਚ ਹੀ ਆਪਣਾ ਜਾਂਦੇ ਹੈ ਕੁਛ ਬੱਚੇ ਸਟੱਡੀ ਕਰਦੇ ਹੈ ਪੜ੍ਹਾਈ ਕਰਦੇ ਹੈ ਅਤੇ ਕੁਛ ਬੱਚੇ ਕਾਰੋਬਾਰ ਵਿੱਚ ਜਾਂਦੇ ਹੈ ਕਿ ਜਿੱਦਾਂ ਕਿ ਕਿਸੇ ਬੱਚੇ ਨੂੰ ਪੜ੍ਹਨਾ ਜ਼ਿਆਦਾ ਪਸੰਦ ਹੈ ਤਾਂ ਉਹ ਪਹਿਲਾਂ ਉੱਚ ਸਿੱਖਿਆ ਪ੍ਰਾਪਤ ਕਰਦਾ ਅਤੇ ਫਿਰ ਨੌਕਰੀ ਵਿੱਚ ਜਾਂਦਾ ਕਿ ਨੌਕਰੀ ਲਾਈਨ 'ਚ ਜਾਂਦਾ ਕੁਛ ਸਰਕਾਰੀ ਨੌਕਰੀਆਂ ਲਈ ਅਪਲਾਈ ਕਰਦੇ ਜਾਂ ਕੁਛ ਬੱਚੇ ਪ੍ਰਾਈਵੇਟ ਨੌਕਰੀਆਂ ਕਰਦੇ ਆ ਅਤੇ ਕੁਛ ਬੱਚੇ ਜਿਨ੍ਹਾਂ ਦਾ ਪੜ੍ਹਾਈ ਵਿੱਚ ਇੰਨਾ ਕੋਈ ਦਿਲਚਸਪੀ ਹੈ ਨਹੀਂ ਤਾਂ ਉਹ ਫਿਰ ਆਪਣਾ ਕਾਰੋਬਾਰ ਸਟਾਰਟ ਕਰਦੇ ਹੈ ਜਾਂ ਕੁਛ ਬੱਚੇ ਜਿੱਦਾਂ ਕਿ ਆਪਣਾ ਹੱਥੀਂ ਕੰਮ ਸਿੱਖ ਕੇ ਕੁਛ ਨਾ ਕੁਛ ਅੱਗੇ ਆਪਣਾ ਕੰਮ ਕਾਰ ਸਟਾਰਟ ਕਰਦੇ ਆ ਸ਼ੁਰੂ ਕਰਦੇ ਆ ਫਿਰ ਕੁਛ ਬੱਚੇ ਆਪਣੇ ਪੜ੍ਹਾਈ ਦੇ ਹੀ ਦੇਖਦੇ ਆ ਉਸ ਦੇ ਅਕੋਡਿੰਗ ਹੀ ਅੱਗੇ ਵਧਦੇ ਆ ਕਿ ਜਿੱਦਾਂ ਜਿਹੜੀ ਉਹਨਾਂ ਨੇ ਪੜ੍ਹਾਈ ਕੀਤੀ ਆ ਉਹਦੇ ਨਾਲ ਹੀ ਕੁਛ ਨਾ ਕੁਛ ਮਿਲਦਾ ਜੁਲਦਾ ਕੋਈ ਵੀ ਕੰਮ ਕਾਰ ਕਰਦੇ ਆ